ਭਾਰਤ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਸਥਾਨ ਜਿਵੇਂ ਕਿ ਆਗਰਾ ਆਗਰਾ ਦਾ ਤਾਜ ਮਹਿਲ ਜੰਮੂ ਕਸ਼ਮੀਰ 'ਚ ਕਸ਼ਮੀਰ ਅਤੇ ਹਿਮਾਚਲ ਵਿੱਚ ਮਨਾਲੀ ਕੁੱਲੂ ਮਨਾਲੀ ਆਦਿ ਸਥਾਨ ਹਨ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਅਤੇ ਅਜੰਤਾ ਆਪਣਾ ਬੰਬੇ ਵਿੱਚ ਅਜੰਤਾ ਉਲਾਰਾ ਓਲੋਰਾ ਦੀਆਂ ਗੁਫਾਵਾਂ ਹਨ ਪ੍ਰਾਚੀਨ ਜੋ ਕਿ ਬੜੀਆਂ ਪ੍ਰਚੀਨ ਹਨ ਇਸ ਤੋਂ ਇਲਾਵਾ ਜਿਹੜੇ ਆਪਣਾ ਟੂਰਿਸਟ ਸੈਲਾਨੀ ਜਿਹੜੇ ਨੇ ਕਾਫੀ ਮਾਤਰਾ ਵਿੱਚ ਇਹਨਾਂ ਇੱਥੇ ਜਾਂਦੇ ਹਨ ਅਤੇ ਉੱਥੇ ਜਾ ਕੇ ਇਹਨਾਂ ਦਾ ਆਨੰਦ ਮਾਣਦੇ ਹਨ ਅਤੇ ਜਿਹੜੀ ਆਪਣਾ ਪੁਰਾਣੀ ਸ਼ਿਲਪ ਕਲਾ ਹੈ ਮੁਗਲਾ ਵੇਲੇ ਸ਼ਿਲਪ ਕਲਾ ਸੀ ਉਹਨੂੰ ਯਾਦ ਕਰਦੇ ਹਨ ਕਿ ਕਿੰਨੇ ਕਿੰਨੇ ਕਿੰਨੇ ਆਪਣਾ ਉਹ ਆਪਣਾ ਬੜਾ ਵ ਵਧੀਆ ਬਿਲਡਿੰਗਾਂ ਦਾ ਕੰਮ ਹੁੰਦਾ ਸੀ ਅਤੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਸਨ